ਕਿ ਮੇਰਾ ਯੂਨੀਵਰਸਿਟੀ ਐਗਰੀਕਲਚਰਲ ਵਾਲਿਆਂ ਦੇ ਅਫਸਰਾਂ ਦੇ ਨਾਲ ਬਹੁਤ ਸ ਸੰਪਰਕ ਹੈ ਜਦੋਂ ਵੀ ਕਿਸੇ ਮੇਲੇ ਵਿੱਚ ਜਾਂਦੇ ਹਨ ਅਤੇ ਪਹਿਲਾਂ ਮੈਨੂੰ ਫੋਨ ਕਰਦੇ ਹਨ ਕਿ ਸਰਦਾਰ ਜੀ ਆਪਣਾ ਸਵੇਰੇ ਜਾਣਾ ਹੈ ਅਸੀਂ ਲੁਧਿਆਣੇ ਗਏ ਸੀਗੇ ਲ ਲੁਧਿਆਣੇ ਜਦੋਂ ਅਸੀਂ ਬੂਟਿਆਂ ਦੀ ਪ੍ਰਦਰਸ਼ਨੀ ਦੇਖੀ ਤਾਂ ਮੈਨੂੰ ਇੱਕ ਅੰਬ ਦਾ ਬੂਟਾ ਬਹੁਤ ਪਸੰਦ ਆਇਆ ਹੈ ਕਿ ਜਦੋਂ ਮੈਂ ਦੇਖਿਆ ਉੱਥੇ ਉਹਦੀਆਂ ਮਤਲਬ ਵੀ ਅੰਬ ਲੱਗੇ ਹੋਏ ਛੋਟੇ ਬੂਟੇ ਨੂੰ ਮੈਂ ਉੱਥੋਂ ਇੱਕ ਬੂਟਾ ਖ਼ਰੀਦ ਕੇ ਲਿਆਂਦਾ ਹੈ ਲਿਆ ਕੇ ਮੈਂ ਆਪਣੇ ਘਰ ਲਗਾਇਆ ਹੈ ਅਤੇ ਬੂਟਾ ਸਾਰਾ ਹੀ ਪੰਜ ਛੇ ਫੁੱਟ ਹੈ ਕਿ ਇੰਨਾ ਬੂਟੇ ਦਾ ਦੇਖਣ ਵਿੱਚ ਦਿਖ ਦੱਸ ਰਿਹਾ ਹਾਂ ਕਿ ਵਜਨ ਨਹੀਂ ਹੈ ਜਿੰਨਾ ਉਹਦੇ ਵਿੱਚ ਅੰਬ ਬਹੁਤ ਵਧੀਆ ਅਤੇ ਬੜੇ ਤਕੜੇ ਸਾਈਜ਼ ਦੇ ਹਨ ਕਿ ਬੂਟਾ ਲੁਚਕ ਰਿਹਾ ਹੈ ਅਸੀਂ ਜਦੋਂ ਅੰਬ ਇਸ ਟਾਇਮ ਪੱਕ ਜਾਂਦਾ ਹੈ ਅਸੀਂ ਉਹਨੂੰ ਖਾਂਦੇ ਹਨ ਤਾਂ ਉਸ ਦਾ ਬਾਹਰ ਦੇ ਫਲਾਂ ਦੇ ਅੰਬਾਂ ਨਾਲੋਂ ਵੱਧ ਸਵਾਦ ਹੈ ਅਤੇ ਇਕ ਮੈਂ ਉੱਥੋਂ ਨਿੰਮ ਦਾ ਬੂਟਾ ਵੀ ਲਿਆਂਦਾ ਹੈ ਕਿ ਸਿਆਣੇ ਕਹਿੰਦੇ ਸਨ ਕਿ ਨਿੰਮ ਜ਼ਰੂਰ ਲਗਾਉਣੀ ਚਾਹੀਦੀ ਹੈ ਘਰ ਦੇ ਵਿੱਚ ਉਸ ਵਿੱਚ ਇਹ ਜਦੋਂ ਉਹਦੇ ਨੀਚੇ ਅਸੀਂ ਛਾਂ ਦੇ ਨੀ ਨੀਚੇ ਬੂਟੇ ਦੇ ਥੱਲੇ ਬੈਠਦੇ ਹਨ ਤਾਂ ਸਾਡੇ ਜਿਹੜੇ ਕੁਦਰਤੀ ਰੋਗ ਹਨ ਉਹ ਇਕ ਦਵਾਈ ਦਾ ਬੂਟਾ ਗਿਣਿਆ ਜਾਂਦਾ ਹੈ ਸਾਡੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਅਤੇ ਬਹੁਤ ਵਧੀਆ ਛਾਂ ਹੈ ਡੰਗਰ ਪਸ਼ੂ ਲਈ ਆਪਣੇ ਮੰਜੇ ਡਾਹੁਣ ਦੀ ਬਿਜਲੀ ਦੀ ਖਪਤ ਤੋਂ ਬਚ ਜਾਂਦੇ ਹਨ